ਮੈਂ ਬਠਿੰਡੇ ਦਾ ਵਾਸੀ ਬੋਲ ਰਿਹਾ ਜਿਨ੍ਹੇ ਜਿਸ ਨੇ ਇੱਧਰ ਮੇਰਾ ਏਰੀਆ ਬਠਿੰਡਾ ਘੁੰਮਣ ਆਉਣਾ ਜਿਸ ਨੇ ਵੀ ਉਹ ਸਰਦੀਆਂ 'ਚ ਆਉਣ ਘੁੰਮਣ ਦੀ ਖਾਤਰ ਕਿਉਂ ਇੱਥੇ ਮਤਲਬ ਗਰਮੀ 'ਚ ਤਾਂ ਬਹੁਤ ਜ਼ਿਆਦਾ ਗਰਮੀ ਹੁੰਦੀ ਇੱਧਰ ਖੜ੍ਹਿਆ ਨਹੀਂ ਜਾਂਦਾ ਬਾਹਰ ਖਲੋਤਾ ਨਹੀਂ ਜਾਂਦਾ ਕਿਸੇ ਪਾਸੇ ਵੀ ਜਾਇਆ ਨਹੀਂ ਜਾਂਦਾ ਅਤੇ ਠੰਡ ਦੇ ਵਿੱਚ ਆਉਣ ਠੰਡ ਦਾ ਮੌਸਮ ਠੰਡ ਦੇ ਵਿੱਚ ਆਉਣ ਠੰਡ ਦੇ ਵਿੱਚ ਵਧੀਆ ਹੁੰਦਾ ਘੁੰਮਣ ਦੇ ਲਈ ਜਾਂ ਜਗ੍ਹਾ ਜਿਵੇਂ ਘੁੰਮਣਾ ਹੋਵੇ ਕਿਲ੍ਹਾ ਸਾਹਿਬ ਹੈ ਇੱਥੇ ਘੁੰਮਣ ਲਈ ਬਠਿੰਡੇ ਘੁੰਮਣ ਲਈ ਅਤੇ ਮਤਲਬ ਕੇ ਵੀ ਇੱਧਰ ਹੋਰ ਜਿਵੇਂ ਝੀਲ ਵਗੈਰਾ ਘੁੰਮਣ ਲਈ ਬਠਿੰਡਾ ਅਤੇ ਹੋਰ ਬਠਿੰਡੇ ਦੀਆਂ ਇਮਾਰਤਾਂ ਮਾਰਕੀਟਾਂ ਬਹੁਤ ਵਧੀਆ ਜਿਵੇਂ ਕਿ ਰੈਸਟੋਰੈਂਟ 'ਚ ਕਿਸੇ ਨੇ ਖਾਣਾ ਵਗੈਰਾ ਖਾਣਾ ਅਤੇ ਉਦੋਂ ਵਧੀਆ ਠੰਡ ਦੇ ਠੰਡ ਦੇ ਮੌਸਮ 'ਚ ਵਧੀਆ ਹੁੰਦਾ ਜੀ ਘੁੰਮਣ ਨੂੰ ਜਗ੍ਹਾ ਅਤੇ ਗਰਮੀ 'ਚ ਜ਼ਿਆਦਾ ਮੁਸ਼ਕਿਲ ਹੋ ਜਾਂਦੀ ਹੈ ਗਰਮੀ 'ਚ ਤਾਂ ਬਹੁਤ ਇੱਧਰ ਗਰਮੀ ਪੈਂਦੀ ਬਹੁਤ ਜ਼ਿਆਦਾ ਅਤੇ ਇਸ ਦੇ ਕਾਰਣ ਜਿਹਨੇ ਇੱਧਰ ਮਤਲਬ ਕੇ ਇੱਧਰ ਆਉਣਾ ਏਰੀਏ 'ਚ ਘੁੰਮਣ ਅਤੇ ਠੰਡ ਦੇ ਮੌਸਮ 'ਚ ਹੀ ਆਉਣ ਮਤਲਬ ਕੇ ਵੀ ਠੰਡੇ 'ਚ ਅਤੇ ਉਦੋਂ ਤਾਂ ਵਧੀਆ ਮਤਲਬ ਕੇ ਵੀ ਘੁੰਮ ਲੈਣ ਜਿਵੇਂ ਜਿਸ ਨੇ ਮਤਲਬ ਕੇ ਫੈਮਿਲੀ ਵਗੈਰਾ ਲੈ ਕੇ ਆਉਣ ਇੱਧਰ ਅਤੇ ਉਹ ਠੰਡ ਦੇ ਮੌਸਮ ਵਿੱਚ ਹੀ ਆਉਣ ਅਤੇ ਤਾਂ ਕਰਕੇ ਇਨ੍ਹਾਂ ਦੇ ਘੁੰਮਣ ਲਈ ਵਧੀਆ ਠੰਡ 'ਚ ਮੌਸਮ ਵਧੀਆ ਹੁੰਦਾ ਜੀ ਅਤੇ ਥੈਂਕ ਯੂ ਜੀ